ਪੰਦਰਾਂ ਜੁਲਾਈ ਉੱਨੀ ਸੌ ਅਠਾਹਠ ਇੱਕ ਜਨਵਰੀ ਉੱਨੀ ਸੌ ਛਿਹੱਤਰ ਸਤਾਰਾਂ ਨਵੰਬਰ ਉੱਨੀ ਸੌ ਤਰਾਨਵੇਂ ਸੋਲ੍ਹਾਂ ਫਰਵਰੀ ਉੱਨੀ ਸੌ ਛਿਆਨਵੇਂ ਪੰਜ ਮਈ ਉੱਨੀ ਸੌ ਸਤਾਨਵੇਂ